ਹੈਲੋ ਸਰ ਤੁਸੀਂ ਕਸਟਮਰ ਐਮਾਜ਼ੋਨ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਸਰ ਮੈਂ ਤੁਹਾਡੇ ਐਮਾਜ਼ੋਨ ਤੋਂ ਚਾਰ ਦਿਨ ਪਹਿਲਾਂ ਇੱਕ ਕਿੱਟ ਔਡਰ ਕੀਤੀ ਸੀ ਆਪਣੀ ਬੱਚੀ ਵਾਸਤੇ ਜਿਹੜੀ ਕਿ ਪੰਜਵੀਂ ਕਲਾਸ ਵਿੱਚ ਪੜ੍ਹਦੀ ਹੈ ਉਹ ਜਿਹੜੀ ਕਿੱਟ ਹੈ ਉਹ ਬਹੁਤ ਹੀ ਵਧੀਆ ਹੈ ਤੁਸੀਂ ਨਾਲੇ ਸਭ ਤੋਂ ਵਧੀਆ ਤਾਂ ਗੱਲ ਜਿਹੜੀ ਤੁਸੀਂ ਮੈਨੂੰ ਕਹਿ ਸੀ ਕਿ ਛੇ ਦਿਨਾਂ ਵਿੱਚ ਡਲੀਵਰੀ ਹੋ ਜਾਊਗੀ ਉਹਦੀ ਡਲੀਵਰੀ ਚਾਰ ਦਿਨਾਂ ਵਿੱਚ ਹੋ ਗਈ ਹੈ ਜਿਹਦੇ ਵਿੱਚ ਜਿਹੜੀ ਪੈਕਿੰਗ ਆ ਉਹ ਬਹੁਤ ਹੀ ਵਧੀਆ ਹੈ ਅਤੇ ਕਿੱਟ ਵੀ ਬਹੁਤ ਵਧੀਆ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਜਿਹੜੀ ਕਿ ਫਾਸਟ ਡਿਲੀਵਰੀ ਕਾਰਨ ਮੇਰੇ ਕੋਲ ਪਹੁੰਚ ਚੁੱਕੀ ਹੈ ਉਹਦੀਆਂ ਚਾਰ ਪੰਜ ਜਿੱਪਾਂ ਹੈ ਜਿਹਦੇ ਵਿੱਚ ਮੇਰੀ ਬੇਟੀ ਨੂੰ ਸਮਾਨ ਰੱਖਣ 'ਚ ਬਹੁਤ ਵਧੀਆ ਆਸਾਨੀ ਹੁੰਦੀ ਹੈ ਅਤੇ ਉਸ ਉਹਦੇ ਵਿੱਚ ਉਹ ਆਸਾਨੀ ਨਾਲ ਆਪਦਾ ਸਾਰਾ ਸਮਾਨ ਰੱਖ ਸਕਦੀ ਹੈ ਲੈ ਜਾ ਸਕਦੀ ਹੈ ਅਤੇ ਬਹੁਤ ਹੀ ਵਧੀਆ ਅਤੇ ਬਹੁਤ ਹੀ ਸੋਹਣੀ ਉਹਦਾ ਦਾ ਰੰਗ ਵੀ ਬਹੁਤ ਹੀ ਸੋਹਣਾ ਹੈ ਜਿਹੜਾ ਕਿ ਪਿਕਚਰ ਵਿੱਚ ਹੈ ਐਮਾਜੋਨ 'ਤੇ ਦਿਖਾਇਆ ਗਿਆ ਸੀਗਾ ਉਹੀ ਰੰਗ ਆ ਅਤੇ ਇਹ ਜਿਹੜੀ ਕਿੱਟ ਹੈ ਇਹ ਪਹਿਲਾਂ ਮੈਂ ਆਪਣੇ ਇੱਥੋਂ ਨਾਲ ਦੇ ਸ਼ਹਿਰ ਵਿੱਚੋਂ ਮੌਲ ਤੋਂ ਦੇਖੀ ਸੀਗੀ ਜਿਹਦਾ ਕਿ ਜਿਹਦਾ ਪ੍ਰਾਈਜ਼ ਬਹੁਤ ਹੀ ਜ਼ਿਆਦਾ ਸੀਗਾ ਅਤੇ ਇਹਦੀ ਕੁਆਲਿਟੀ ਵੀ ਬਹੁਤ ਘਟੀਆ ਸੀ ਅਤੇ ਇੰਨੀ ਸੋਹਣੀ ਨਹੀਂ ਸੀ ਇਹਦਾ ਰੰਗ ਵੀ ਸ਼ੇਡ ਮੈਨੂੰ ਨਹੀਂ ਮਿਲਿਆ ਸੀਗਾ ਅਤੇ ਇਹ ਜਿਹੜੇ ਤੁਹਾਡੇ ਤੁਸੀਂ ਤੁਹਾਡੇ ਕੋਲ ਔਡਰ ਕੀਤੀ ਇਹਦੀ ਕੁਆਲਿਟੀ ਬਹੁਤ ਵਧੀਆ ਆਏਗੀ ਉਹ ਇਹਦਾ ਤਾਂ ਪ੍ਰਾਈਜ਼ ਵੀ ਬਹੁਤ ਘੱਟ ਆ ਇਹਦੇ ਨਾਲ ਦੀਆਂ ਚਾਰ ਪੰਜ ਔਡਰ ਮੈਂ ਹੋਰ ਕਰਾਂਗੀ ਅਤੇ ਆਪਣੇ ਫੈਮਲੀ ਮੈਂਬਰ ਨੂੰ ਵੀ ਕਹਾਂਗੀ ਕਿ ਐਮਾਜੋਨ ਤੋਂ ਵਧੀਆ ਔਡਰ ਕਰ ਲਓ ਕਿਉਂਕਿ ਇਹਦੇ ਵਿੱਚ ਜਿਹੜੇ ਤਾਂ ਅਸੀਂ ਜਿਹੜੇ ਬਹੁਤ ਵਧੀਆ ਪ੍ਰਾਈਸ ਮਿਲ ਜਾਂਦਾ ਵਧੀਆ ਜੇ ਕੁਆਲਿਟੀ ਮਿਲ ਜਾਂਦੀ ਹੈ ਅਤੇ ਵਧੀਆ ਰੰਗ ਮਿਲ ਜਾਂਦਾ ਜਿਹੜੇ ਸਾਨੂੰ ਚਾਹੀਦੇ ਹੁੰਦੇ ਸਨ ਅਤੇ ਇਹਦੇ ਵਿੱਚ ਤੁਸੀਂ ਬਹੁਤ ਹੀ ਵਧੀਆ ਮਤਲਬ ਪ੍ਰੋਡਕਟ ਭੇਜਦੇ ਹੈਗੇ ਓ ਅਤੇ ਵਧੀਆ ਸਾਨੂੰ ਸਾਡੇ ਤੱਕ ਡਿਲੀਵਰੀ ਕਰਦੇ ਹੋ ਇਹਦੀ ਫਾਸਟ ਡਿਲੀਵਰੀ ਹੁੰਦੀ ਅੱਗੇ ਤੋਂ ਵੀ ਸਾਨੂੰ ਇੱਦਾਂ ਵਧੀਆ ਚੀਜ਼ਾਂ ਔਡਰ ਕਰ ਵਧੀਆ ਡਿਲੀਵਰੀ ਕਰੋ ਵਧੀਆ ਅਤੇ ਫਾਸਟ ਡਿਲੀਵਰ ਕਰੋ